ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਤੁਸੀਂ ਗੋਲਡਨ ਟੈਂਪਲ ਸ਼੍ਰੀ ਦਰਬਾਰ ਸਾਹਿਬ ਜਾ ਸਕਦੇ ਜੀ ਮੋਹਾਲੀ ਤੋਂ ਐਸਪ੍ਰੈਕਸ ਵੀ ਜਾਂਦੀ ਹੈ ਜੀ ਜਨਰਲ ਡੱਬੇ ਵੀ ਜਾਂਦੇ ਹੈ ਜੀ ਰੇਲਗੱਡੀ ਔਰ ਉਸਤੋਂ ਬਾਅਦ ਤੁਸੀਂ ਇੱਧਰ ਜੰਮੂ ਸਾਈਡ ਵੀ ਜਾ ਸਕਦੇ ਹੋ ਘੁੰਮਣ ਜਿੱਥੇ ਘੰਟਾ ਘਰ ਹੈ ਬੜਾ ਹਿੱਲ ਏਰੀਆ ਹੈ ਹਾਂਜੀ ਉੱਥੇ ਤੱਕ ਵੀ ਟਰੇਨ ਜਾਂਦੀ ਹੈ ਔਰ ਤੁਸੀਂ ਇੱਧਰ ਦਿੱਲੀ ਵੀ ਜਾ ਸਕਦੇ ਇੰਡੀਆ ਗੇਟ ਵੀ ਦੇਖ ਸਕਦੇ ਹੋ ਇਹ ਡੱਬੇ ਦੇ ਹਿਸਾਬ ਨਾਲ਼ ਹੈ ਜੀ ਜਿਸ ਤਰ੍ਹਾਂਂ ਤੁਸੀਂ ਸਲੀਪਰ ਡੱਬਾ ਬੁੱਕ ਕਰਦੇ ਹੋ ਤਾਂ ਉਹਦੇ ਸਮਥਿੰਗ ਮਤਲਬ ਦੋ ਸੌ ਸੱਤਰ ਜਾਂ ਦੋ ਸੌ ਸੱਠ ਦੇ ਕਰੀਬ ਹੈ ਜਨਰਲ ਦੇ ਥੋੜ੍ਹੇ ਘੱਟ ਹੈ ਜੀ ਸੱਤਰ ਜਾਂ ਅੱਸੀ ਰੁਪਏ ਦੇ ਵਿੱਚ ਵਿੱਚ ਹੈ ਔਰ ਜਿਹੜਾ ਏਸੀ ਹੈ ਉਹਦੇ ਮਤਲਬ ਪੰਜ ਸੌ ਦੇ ਉੱਤੇ ਹੁੰਦੇ ਹੈ ਜੀ ਛੇ ਸੌ ਸਮਥਿੰਗ ਇੰਨੇ ਦੇ ਵਿੱਚ ਵਿੱਚ ਹਾਂਜੀ ਖਾਣਾ ਜੀ ਏ ਵੰਨ ਹੈ ਮਤਲਬ ਡੱਬੇ ਦੇ ਹਿਸਾਬ ਨਾਲ਼ ਜਿਸ ਤਰ੍ਹਾਂ ਤੁਸੀਂ ਬਾਕੀ ਤਾਂ ਸ਼ਹਿਰਾਂ ਦੇ ਵਿੱਚ ਜਿੱਥੇ ਟਰੇਨ ਰੁਕਦੀ ਹੈ ਉੱਥੇ ਤਾਂ ਬਾਹਰ ਦੀ ਲੈਣਾ ਪੈਂਦਾ ਅਗਰ ਤੁਸੀਂ ਏਸੀ ਵਿੱਚ ਲੈਂਦੇ ਹੋ ਤਾਂ ਤੁਹਾਨੂੰ ਖਾਣਾ ਅੰਦਰ ਹੀ ਪ੍ਰੋਵਾਈਡ ਹੋਏਗਾ ਖਾਣਾ ਏ ਵੰਨ ਹੁੰਦਾ ਜੀ ਵਧੀਆ ਹੁੰਦਾ ਹਾਂਜੀ ਹਾਂਜੀ ਏਸੀ ਡੱਬੇ ਦੇ ਵਿੱਚ ਤੁਹਾਨੂੰ ਪੂਰਾ ਲਗਜ਼ਰੀ ਰੂਮ ਮਿਲੇਗਾ ਜੀ ਐਨ ਵਧੀਆ ਮਤਲਬ ਕੋਈ ਤੰਗ ਪ੍ਰੇਸ਼ਾਨ ਨਹੀਂ ਕਰਦਾ ਬਾਹਰ ਤੋਂ ਪਸੈਂਜਰ ਆ ਕੇ ਕੋਈ ਵੀ ਉਹਦੇ ਵਿੱਚ ਤੁਹਾਨੂੰ ਐਨ ਵਧੀਆ ਫੈਸੇਲੀਟੀ ਮਿਲੇਗੀ ਜੀ ਹਾਂਜੀ ਠੀਕ ਹੈ ਜੀ ਓਕੇ